ਪੰਜਾਬ ਵਿੱਚ ਅਭਿਆਸ ਕੀਤੇ ਗਏ ਜਿਹੜੇ ਵੱਖ ਵੱਖ ਧਰਮ ਸਮਾਜਿਕ ਨਿਆਂ ਜਾਂ ਸਮਾਨਤਾ ਦੇ ਮੁੱਦੇ ਨੇ ਹੈ ਨਾ ਜਿਵੇਂ ਮਨੁੱਖੀ ਅਧਿਕਾਰ ਆ ਉਹਦੇ ਵਿੱਚ ਮੁੰਡੇ ਅਤੇ ਕੁੜੀਆਂ ਨੂੰ ਜਿਹੜੀ ਸਮਾਨਤਾ ਦੇਣੀ ਸ਼ੁਰੂ ਕਰਤੀ ਪਹਿਲਾਂ ਇਹ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ ਜਿਵੇਂ ਉਹਨਾਂ ਨੂੰ ਨੌਕਰੀਆਂ ਦਾ ਕਰਨ ਦਾ ਅਧਿਕਾਰ ਪੜ੍ਹਾਈ ਦਾ ਅਧਿਕਾਰ ਕੰਮ ਕਰਨ ਦਾ ਅਧਿਕਾਰ ਕਿਸੇ ਵੀ ਖੇਤਰ ਵਿੱਚ ਰਹਿ ਕੇ ਕੋਈ ਵੀ ਤ ਕ ਨਾਗਰਿਕਤਾ ਪ੍ਰਾਪਤ ਕਰਨ ਦਾ ਅਧਿਕਾਰ ਇਹ ਸਾਰਾ ਹੈ ਨਾ ਬਹੁਤ ਜ਼ਿਆਦਾ ਚੇਂਜ ਆਇਆ ਸਾਡੇ ਸਮਾਜ ਦੇ ਵਿੱਚ ਉਹ ਤੋਂ ਬਾਅਦ ਜਿਹੜੀ ਲਿੰਗ ਸਮਾਨਤਾ ਠੀਕ ਹੈ ਉਹ ਉਹਦੇ ਵਿੱਚ ਵੀ ਜਿਵੇਂ ਪਹਿਲਾਂ ਸਭ ਤੋਂ ਪਹਿਲਾਂ ਕੁੜੀਆਂ ਨੂੰ ਜਿਹੜਾ ਐਨਾ ਚੰਗਾ ਨਹੀਂ ਸੀ ਸਮਝਿਆ ਜਾਂਦਾ ਮੁੰਡਿਆਂ ਦੇ ਬਰਾਬਰ ਦਰਜਾ ਨਹੀਂ ਸੀ ਦਿੱਤਾ ਜਾਂਦਾ ਪਰ ਅੱਜ ਦੇ ਸਮੇਂ ਦੇ ਵਿੱਚ ਕੁੜੀਆਂ ਅਤੇ ਮੁੰਡਿਆਂ ਨੂੰ ਬਰਾਬਰ ਦਾ ਸਮਾਂ ਦਿੱਤਾ ਜਾਂਦਾ ਅਤੇ ਬਰਾਬਰ ਉਹਨਾਂ ਨੂੰ ਸਮਝਿਆ ਜਾਂਦਾ ਘੱਟ ਗਿਣਤੀ ਵਾਲੇ ਜਿਵੇਂ ਸਿੱਖ ਅਤੇ ਮੁਸਲਮਾਨਾਂ ਨੇ ਉਹਨਾਂ ਦੇ ਵਿੱਚ ਅੱਗੇ ਵਿਤਕਰਾ ਕੀਤਾ ਜਾਂਦਾ ਸੀ ਘੱਟ ਗਿਣਤੀਆਂ ਨੂੰ ਐਨੀ ਤਰਜੀਹ ਨਹੀਂ ਸੀ ਦਿੱਤੀ ਜਾਂਦੀ ਪਰ ਹੁਣ ਸਾਡੀਆਂ ਸਰਕਾਰਾਂ ਨੇ ਘੱਟ ਗਿਣਤੀ ਵਾਲ਼ੇ ਲੋਕਾਂ ਨੂੰ ਬਹੁਤ ਜ਼ਿਆਦਾ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ